ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਿਲ ਹੋਣ ਲਈ ਬਹੁਤ ਹੀ ਮਦਦ ਕੀਤੀ ਹੈ ਪਲੇਟਫਾਰਮ ਜਿਵੇਂ ਕਿ ਯੂਟੀਊਬ ਆਦਿ 'ਤੇ ਆਪਾਂ ਐਡ ਵੀਡੀਓਗ੍ਰਾਫੀ ਰਾਹੀਂ ਆਪਣੇ ਵਿਚਾਰ ਆਪਣੀ ਕਲਾ ਨੂੰ ਸ਼ਿਲਪਕਾਰੀ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਇਸ ਪਲੈਟਫਾਰਮ ਨਾਲ ਦੇਸ਼ਾਂ ਵਿਦੇਸ਼ਾਂ ਦੇ ਲੋਕ ਜੁੜੇ ਹੁੰਦੇ ਹਨ ਜਿਸ ਨਾਲ ਕਲਾ ਦਾ ਵਿਸਤਾਰ ਦੇਸ਼ਾਂ ਵਿਦੇਸ਼ਾਂ ਤੱਕ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਬਹੁਤ ਹੀ ਉੱਚੇ ਪੱਧਰ 'ਤੇ ਪਹੁੰਚਾਇਆ ਜਾ ਸਕਦਾ ਹੈ ਕਲਾ ਨੂੰ ਉੱਤੇ ਸੋਸ਼ਲ ਮੀਡੀਆ ਰਾਹੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਆਪਾਂ ਹੋਰ ਲੋਕਾਂ ਤੱਕ ਵੀ ਪਹੁੰਚਾ ਸਕਦੇ ਹਾਂ ਹਾਂ ਮੈਂ ਇੱਕ ਆਰਟ ਐਂਡ ਕਰਾਫਟ ਯੂਟਿਊਬ ਚੈਨਲ ਹ ਜਿਸ ਦਾ ਅਨੁਸਰਨ ਕਰਦਾ ਹਾਂ ਜੋ ਕਿ ਮੇਰੀ ਭੈਣ ਯਸ਼ਿਕਾ ਦੁਆਰਾ ਬਣਾਇਆ ਗਿਆ ਹੈ ਜਿਸ ਦਾ ਨਾਮ ਡਰਾਇੰਗ ਵਰਡ ਦੇ ਨਾਮ ਤੋਂ ਹੈ ਮੈਂ ਇਸ ਨੂੰ ਪਸੰਦ ਕਰਦਾ ਹਾਂ ਇਸ ਲਈ ਮੈਂ ਇਸਦਾ ਅਨੁਸਰਨ ਕਰਦਾ ਹਾਂ ਧੰਨਵਾਦ